ਮੈਂ ਓਨਲਾਈਨ ਇੱਕ ਕੁੜਤੀ ਮੰਗਵਾਈ ਸੀ ਅਤੇ ਉਹਦੇ ਵਿੱਚ ਮੈਨੂੰ ਜਿਹੜਾ ਨੈੱਟ 'ਤੇ ਦਿਖਾਇਆ ਸੀ ਉਹਦਾ ਕਲਰ ਬਹੁਤ ਹੀ ਵਧੀਆ ਸੀ ਅਤੇ ਉਹਦੀ ਕੁੜਤੀ ਦੇ ਵਿਊਜ਼ ਸੀ ਵੀ ਬਹੁਤ ਹੀ ਵਧੀਆ ਆ ਰਹੇ ਸੀ ਇਸ ਕਰਕੇ ਮੈਂ ਓਰਡਰ ਕਰ ਦਿੱਤਾ ਕਿ ਮੈਨੂੰ ਇਹ ਕੁੜਤੀ ਚਾਹੀਦੀ ਹੈ ਉਹਦਾ ਕਲਰ ਉਹਦੀ ਲੈਂਥ ਉਹਦਾ ਸਾਈਜ਼ ਵੀ ਬਹੁਤ ਹੀ ਮਤਲਬ ਕਿ ਮੈਨੂੰ ਠੀਕ ਲੱਗਾ ਸੀ ਜਿਹੜਾ ਕਿ ਓਨਲਾਈਨ ਕੁੜਤੀ ਮੰਗਵਾ ਕੇ ਨਾ ਮੈਨੂੰ ਉਹ ਸਾਈਜ਼ ਮਿਲਿਆ ਨਾ ਮੈਨੂੰ ਉਹ ਰੰਗ ਮਿਲਿਆ ਅਤੇ ਉਹਦਾ ਕੱਪੜਾ ਵੀ ਬਹੁਤ ਹੀ ਜ਼ਿਆਦਾ ਰਫਲੀ ਸੀ ਇਸ ਕਰਕੇ ਮੈਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਜਿਹੜਾ ਵੈ ਉਹ ਕੁੜਤੀ ਮੈਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਮੈਨੂੰ ਇਹ ਕੁੜਤੀ ਨਹੀਂ ਚਾਹੀਦੀ ਹੈਗੀ ਅਤੇ ਉਹ ਜਿਹੜਾ ਕੁੜਤੀ ਦਾ ਕੱਪੜਾ ਇੰਨਾ ਕੁ ਖਰਾਬ ਸੀ ਨਾ ਫਸਟ ਵੋਸ਼ ਦੇ ਉੱਤੇ ਹੀ ਉਹ ਜਿਹੜੀ ਕੁੜਤੀ ਦਾ ਰੰਗ ਜਿਹੜਾ ਹੈ ਹੋਰ ਵੀ ਨਿਕਲ ਗਿਆ ਅਤੇ ਜਿਹੜਾ ਮੈਂ ਰੰਗ ਸਲੈਕਟ ਕੀਤਾ ਸੀ ਉਹ ਤਾਂ ਰੰਗ ਉਹਨਾਂ ਨੇ ਭੇਜਿਆ ਹੀ ਨਹੀਂ ਜਿਹੜਾ ਦੂਜਾ ਵੀ ਭੇਜਿਆ ਸੀ ਉਹ ਵੀ ਫਸਟ ਵਾਸ਼ ਦੇ ਵਿੱਚ ਦੁਬਾਰਾ ਹੋਰ ਤਰ੍ਹਾਂ ਦਾ ਹੋ ਗਿਆ ਜਿਸ ਕਰਕੇ ਮੈਨੂੰ ਉਹ ਬਿਲਕੁਲ ਵੀ ਅੱਛਾ ਨਹੀਂ ਲੱਗਾ ਇਸ ਕਰਕੇ ਮੈਂ ਉਹਨਾਂ ਨੂੰ ਕੰਪਨੀ ਵਾਲਿਆਂ ਨੂੰ ਰਿਕੁਐਸਟ ਕੀਤੀ ਕਿ ਜਿਹੜਾ ਇਹ ਤੁਸੀਂ ਪੀਸ ਭੇਜਿਆ ਇਹ ਵਾਪਸ ਲੈ ਜਾਉ ਅਤੇ ਮੈਨੂੰ ਇਹਦੇ ਬਦਲੇ ਕੋਈ ਹੋਰ ਵਧੀਆ ਜਿਹਾ ਪੀਸ ਦਿੱਤਾ ਜਾਵੇ ਤਾਂ ਕਿ ਜਿਹੜਾ ਹੈ ਉਹ ਕੁੜਤੀ ਹੈ ਉਹ ਮੇਰੇ ਬਿਲਕੁਲ ਵੀ ਮਨਪਸੰਦ ਨਹੀਂ ਹੈ ਇਸ ਕਰਕੇ ਮੈਂ ਜਿਹੜਾ ਓਨਲਾਈਨ ਲੈ ਚੀਜ਼ਾਂ ਲੈਣ ਵਾਸਤੇ ਲੈਣ ਦੇ ਹੱਕਦਾਰ ਵਿੱਚ ਨਹੀਂ ਹੈ ਕਿਉਂਕਿ ਇਹ ਜੋ ਦਿਖਾਉਂਦੇ ਆ ਉਹ ਹੁੰਦਾ ਨਹੀਂ ਹੈ ਅਤੇ ਜਿਹੜਾ ਸਾਨੂੰ ਚਾਹੀਦਾ ਹੁੰਦਾ ਉਹ ਤਾਂ ਬਿਲਕੁਲ ਹੀ ਨਹੀਂ ਭੇਜਦੇ ਉਹ ਕੱਪੜਾ ਵੀ ਹੋਰ ਦਿਖਾ ਦਿੰਦੇ ਹੈ ਜਿਹੜਾ ਕਿ ਸਾਡੇ ਪਸੰਦ ਦਾ ਨਹੀਂ ਹੁੰਦਾ ਇਸ ਕਰਕੇ ਓਨਲਾਈਨ ਜਿਹੜੀ ਹੈ ਚੀਜ਼ਾਂ ਮੰਗਵਾਉਣ ਲਈ ਮੈਂ ਪ੍ਰੈਫਰ ਨਹੀਂ ਕਰਾਂਗੀ ਮੈਂ ਕਹਾਂਗੀ ਕਿ ਆਪ ਦੇਖ ਕੇ ਵਧੀਆ ਚੀਜ਼ ਤੁਸੀਂ ਲੈ ਸਕਦੇ ਹੋ ਜਦਕਿ ਓਨਲਾਈਨ ਦੇ ਵਿੱਚ ਉਹ ਚੀਜ਼ ਇਸਤੇਮਾਲ ਦੇ ਵਿੱਚ ਨਹੀਂ ਆਉਂਦੀ ਜਦਕਿ ਉਹਦੀ ਲੈਸ ਵਗੈਰਾ ਵੀ ਬਹੁਤ ਹੀ ਜ਼ਿਆਦਾ ਡੈਮੇਜ ਹੋ ਜਾਂਦੀ